ਹੁਣ ਵਾਲੇ ਫੋਨ ਅਤੇ ਪੁਰਾਣੇ ਫੋਨ ਵਿੱਚ ਬਹੁਤ ਅੰਤਰ ਸੀ ਜਿਹੜਾ ਪੁਰਾਣਾ ਫੋਨ ਸੀ ਉਹਦੇ ਵਿੱਚ ਸਿੰਪਲ ਅਸੀਂ ਕਾਲ ਕਰ ਸਕਦੇ ਸੀ ਜਾਂ ਕਾਲ ਆ ਸਕਦੀ ਤੀ ਜਾਂ ਅਸੀਂ ਮੈਸੇਜ ਐਸ ਐਮ ਐਸ ਕਰ ਸਕਦੇ ਸੀ ਜਾਂ ਐਸ ਐਸ ਐਸ ਐਮ ਐਸ ਆ ਸਕਦਾ ਸੀ ਜਿਹੜੇ ਹੁਣ ਵਾਲੇ ਫੋਨ ਐਨਡਰਾਇਡ ਹੈ ਉਹਦੇ ਵਿੱਚ ਅਸੀਂ ਵੀਡੀਓ ਕਾਲ ਵੀ ਕਰ ਸਕਦੇ ਹਾਂ ਸਾਡੇ ਕੋਲ ਵੀਡੀਉ ਵੀ ਆ ਸਕਦੀ ਹੈ ਅਸੀਂ ਫੋਟੋੇਆਂ ਵੀ ਕਲਿੱਕ ਕਰ ਸਕਦੇ ਹਾਂ ਅਤੇ ਇਸ ਅਸੀਂ ਜੇ ਕੋਈ ਬਾਹਰ ਵੀ ਕੋਈ ਦੇਸ਼ ਵਿੱਚ ਬੰਦਾ ਬੈਠਿਆ ਹੋਏ ਉਹਦੇ ਨਾਲ ਵੀ ਅਸੀਂ ਵੀਡੀਉ ਕਾਲ ਕਰ ਸਕਦੇ ਹਨ ਮੈਂ ਮੇਰਾ ਜਿਹੜਾ ਫੋਨ ਹੈ ਉਸ ਵਿੱਚ ਮੈਂ ਜੀਉ ਦਾ ਸਿਮ ਵਰਤਦਾ ਹਾਂ ਜੀਉ ਦਾ ਜਿਹੜਾ ਮੇਰਾ ਤਿੰਨ ਮਹੀਨੇ ਦਾ ਰੀਚਾਰਜ ਹੈ ਉਹ ਸੱਤ ਸੋ ਉੱਨ੍ਹੀ ਰੁਪਏ ਦਾ ਹੁੰਦਾ ਹੈ ਇਹ ਇਸ ਵਿੱਚ ਮੈਨੂੰ ਇੱਕ ਦਿਨ ਦਾ ਡੇਢ ਜੀ ਬੀ ਡਾਟਾ ਮਿਲਦਾ ਹੈ ਅਤੇ ਅਨਲਿਮਟਿਡ ਕਾਲ ਮਿਲਦੀ ਹੈ ਜੋ ਮੈਂ ਤਿੰਨ ਮਹੀਨੇ ਅਨਲਿਮਟਿਡ ਵਰਤਦਾ ਹਾਂ